ਮੈਨੂੰ ਗਰਮੀਆਂ ਬਹੁਤ ਪਸੰਦ ਨੇ ਕਿਉਂਕਿ ਗਰਮੀਆਂ ਵਿੱਚ ਤੋਂ ਮਤਲਬ ਦਿਨ ਵੀ ਵੱਡੇ ਹੁੰਦੇ ਨੇ ਜੇ ਤੁਸੀਂ ਕਿਤੇ ਆ ਜਾ ਸਕਣਾ ਹੋਵੇ ਤਾਂ ਤੁਸੀਂ ਘੁੰਮ ਫਿਰ ਵੀ ਸਕਦੇ ਓਂ ਉਹਦੇ 'ਚ ਤੁਹਾਨੂੰ ਟਾਈਮ ਜਿਹੜਾ ਉਹ ਜ਼ਿਆਦਾ ਮਿਲ ਜਾਂਦਾ ਐਜ ਕੰਪੇਅਰ ਟੂ ਕਿ ਜੇ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਉਹਦੇ 'ਚ ਜਿਹੜਾ ਹਨੇਰਾ ਹੈਗਾ ਉਹ ਬਹੁਤ ਜਲਦੀ ਹੋ ਜਾਂਦਾ ਵੈ ਦੂਸਰਾ ਗਰਮੀਆਂ ਦਾ ਇਹ ਹੁੰਦਾ ਕਿ ਤੁਸੀਂ ਮਤਲਬ ਤੁਹਾਨੂੰ ਜੇ ਤੁਸੀਂ ਕਿਤੇ ਜਾਣਾ ਘੁੰਮਣ ਵਾਸਤੇ ਤਾਂ ਤੁਹਾਨੂੰ ਮਤਲਬ ਕੈਰੀ ਕਰਨ ਲਈ ਨਹੀਂ ਇੰਨਾਂ ਸਮਾਨ ਲੈ ਕੇ ਜਾਣਾ ਪੈਂਦਾ ਅਤੇ ਉੱਤੋਂ ਜਿਹੜਾ ਮਤਲਬ ਜਿਹੜਾ ਗਰਮੀਆਂ ਦਾ ਮੌਸਮ ਹੈਗਾ ਉਦੋਂ ਫਲਾਵਰਸ ਵਗੈਰਾ ਕਾਫ਼ੀ ਮਤਲਬ ਹੁੰਦੇ ਨੇ ਹੈ ਨਾ ਅਤੇ ਥੋੜ੍ਹਾ ਕਈ ਵਾਰੀ ਮੌਸਮ ਜਿਹੜਾ ਸ਼ਾਮ ਨੂੰ ਬੜਾ ਵਧੀਆ ਹੋ ਜਾਂਦਾ ਤੁਸੀਂ ਘੁੰਮ ਫਿਰ ਸਕਦੇ ਹੋ ਸੈਰ ਕਰ ਸਕਦੇ ਹੋ ਅਤੇ ਹੋਰ ਵੀ ਤੁਹਾਨੂੰ ਵਧੀਆ ਮਤਲਬ ਲੱਗਦਾ ਈਵਨ ਤੁਸੀਂ ਘਰ ਦੇ ਵੀ ਕੰਮ ਕੁੰਮ ਵਧੀਆ ਕਰ ਸਕਦੇ ਹੋ ਸਰਦੀਆਂ ਵਿੱਚ ਅਤੇ ਘਰ ਦੇ ਕੰਮ ਵੀ ਨਹੀਂ ਹੁੰਦੇ ਅਤੇ ਬਸ ਬੰਦਾ ਰਜਾਈ 'ਚ ਵੜਿਆ ਰਹਿੰਦਾ ਅਤੇ ਹੋਰ ਇਸ ਗਰਮੀਆਂ ਦੇ ਮੌਸਮ ਵਿੱਚ ਇਹ ਵੀ ਵਧੀਆ ਹੁੰਦਾ ਕਿ ਕਈ ਵਾਰੀ ਸ਼ਾਮ ਨੂੰ ਹਲਕੀ ਹਲਕੀ ਬਾਰਿਸ਼ ਹੋਣ ਲਾ ਪੈਂਦੀ ਆ ਜਿਹਦੇ ਨਾਲ਼ ਮੌਸਮ ਜਿਹੜਾ ਉਹ ਹੋਰ ਵਧੀਆ ਹੋ ਜਾਂਦਾ ਵੈ ਅਤੇ ਮੈਨੂੰ ਵੈਸੇ ਵੀ ਬਾਰਿਸ਼ 'ਚ ਨਹਾਉਣਾ ਬਹੁਤ ਪਸੰਦ ਹੈਗਾ ਅਤੇ ਗਰਮੀਆਂ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਅਤੇ ਉਹਦਾ ਜਿਹੜਾ ਮਜ਼ਾ ਹੁੰਦਾ ਉਹ ਮਤਲਬ ਆਪਣਾ ਡਿਫਰੈਂਟ ਹੀ ਹੁੰਦਾ ਵੈ ਇਸ ਲਈ ਮੈਨੂੰ ਗਰਮੀਆਂ ਦਾ ਮੌਸਮ ਜਿਹੜਾ ਉਹ ਜ਼ਿਆਦਾ ਪਸੰਦ ਆ ਸਰਦੀਆਂ ਨਾਲ਼ੋਂ